ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਹਾਂਜੀ ਦੱਸੋ ਜੀ ਕੀ ਕੰਮ ਸੀ ਹਾਂਜੀ ਹਾਂਜੀ ਹਾਂਜੀ ਸਟਿੱਚ ਕਰਾਉਣਾ ਸੀ ਕੋਈ ਗੱਲ ਨੀ ਦੱਸੋ ਕਰ ਦਿਆਗੇ ਜੀ ਠੀਕ ਹੈ ਜੀ ਕਿੰਨੀ ਤਰੀਕ ਨੂੰ ਫੰਕਸ਼ਨ ਹੈ ਤੁਹਾਡੇ ਅੱਛਾ ਜੀ ਪ੍ਰੋਗਰਾਮ 'ਤੇ ਪਾਉਣਾ ਹੈ ਕੋਈ ਗੱਲ ਨੀ ਸੀਅ ਦਿਆਂਗੇ ਅਤੇ ਤੁਸੀਂ ਮੈਨੂੰ ਦੱਸ ਦਿਓ ਕਿਹੜਾ ਸਿਲਵਾਉਣਾ ਹੈ ਸਿੰਪਲ ਸਿਲਵਾਉਣਾ ਹੈ ਸਿੰਪਲ ਸਾਦਾ ਸੀਉਣਾ ਹੈ ਨੋਰਮਲ ਹਾਂਜੀ ਸਾਈਡਾਂ 'ਤੇ ਪਾਈਪਿੰਗ ਲੱਗ ਜਾਵੇਗੀ ਜੇ ਬਾਹਾਂ 'ਤੇ ਕਢਾਈ ਕਰਵਾਉਣੀ

ਹਾਂਜੀ ਹਾਂਜੀ ਹੋੋਜੂਗਾ ਜੀ ਠੀਕ ਹੈ ਜੀ ਕੀ ਗੱਲ ਹੋਈ ਹੁਣ ਅੱਜ ਕੱਲ੍ਹ ਆਉਂਦੇ ਨੀ ਸੂਟ ਸਿਲਾਣ ਕਿੱਧਰ ਜਾਣ ਲ਼ਗ ਪਏ ਜੀ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਜ਼ਰੂਰ ਮੌਕਾ ਦਿੰਦੇ ਰਿਹਾ ਕਰੋ ਅਤੇ ਮੈਨੂੰ ਦੱਸ ਦਿਓ ਬਈ ਤੁਸੀਂ ਨਾਪ ਦੇਦੋਂਗੇ ਹੁਣੇ ਜਾਂ ਕਦੋਂ ਜਾਂ ਸੈਂਡ ਕਰਦੋਂਗੇ ਮੈਨੂੰ ਵੱਟਸਅੱਪ 'ਤੇ ਹਾਂਜੀ ਸਾਰਾ ਜੋ ਪਰੋਪਰ ਸਾਈਜ਼ ਹੈ ਜੋ ਸਹੀ ਹੈ ਮੈਨੂੰ ਲਿਖ ਕੇ ਸੈਂਡ ਕਰ ਦਿਓ ਅਤੇ ਕੋਈ ਨੀ ਤੁਸੀਂ ਕੱਪੜਾ ਫੜਾ ਜਿਓ ਮੈਨੂੰ ਜਦੋਂ ਟਾਈਮ ਲੱਗਿਆ ਜੇ ਤੁਸੀਂ ਮੈਨੂੰ ਦੱਸਦੋ ਕਿਸ ਕਲਰ ਰੰਗ ਦਾ ਲੈਂਣਾ ਹੈ ਤਾਂ ਮੈਂ ਆਪ ਸਿਲਾਈ ਕਰਾ ਦਵਾਂਗਾ ਲੈ ਕੇ ਠੀਕ ਹੈ ਨਾ ਹਾਂਜੀ ਹੋਰ ਕੋਈ ਜੇ ਘਰਦਿਆ ਨੇ ਕਿਸੇ ਨੇ ਸੂਟ ਸਿਲਾਉਣੇ ਹੋਏ ਦੱਸਦਿਆ ਕਰੋ ਮੌਕਾ ਦਿਆ ਕਰੋ ਵੱਧ ਤੋਂ ਵੱਧ ਠੀਕ ਹੈ ਹਾਂਜੀ ਹਾਂਜੀ ਆਪਾਂ ਉਹ ਪਟਿਆਲਾ ਸ਼ਾਹੀ ਸਲਵਾਰਾਂ ਪੰਜਾਬੀ ਸੂਟ ਜਿੱਦਾਂ ਦੇ ਵੀ ਅੱਜ ਕੱਲ੍ਹ ਸੱਭਿਆਚਾਰ ਦੇ ਅਨੁਸਾਰ ਚੱਲਦੇ ਹੈ ਹਰ ਤਰ੍ਹਾਂ ਦੀ ਸਿਲਾਈ ਕਰਵਾਈ ਦੀ ਆ ਜੀ ਠੀਕ ਹੈ ਜੀ ਹਾਂਜੀ ਫ਼ੋਨ ਨੰਬਰ ਆਪਣਾ ਇਹ ਹੀ ਹੈ ਹਾਂਜੀ ਸਭ ਵਧੀਆ ਜੀ ਫ਼ੋਨ ਨੰਬਰ ਆਪਣਾ ਇਹ ਹੀ ਚੱਲਦਾ ਹੈ ਜਦੋਂ ਮਰਜ਼ੀ ਤੁਸੀਂ ਫ਼ੋਨ ਕਰਕੇ ਸਾਨੂੰ ਦੱਸ ਸਕਦੇ ਓ ਸੂਟ ਸਿਲਾਉਣਾ ਹੈ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਓਕੇ